ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਪਿਕਨਿਕ ਲਈ ਜਾਂਦਾ ਹਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜੋ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਹੈ ਹਾਂ ਉਸ ਥਾਂ ਦੇ ਉੱਤੇ ਅਸੀਂ ਇੱਕ ਨਵੰਬਰ ਨੂੰ ਜਾਂਦੇ ਹਾਂ ਹਰ ਸਾਲ ਕਿਉਂਕਿ ਉੱਥੇ ਪੰਜਾਬ ਦੇ ਲੋਕਾਂ ਦਾ ਜੋ ਇਤਿਹਾਸ ਹੈ ਗਦਰੀ ਬਾਬਿਆਂ ਦਾ ਜੋ ਇਤਿਹਾਸ ਹੈ ਜੋ ਭਗਤ ਸਰਾਭਿਆਂ ਦਾ ਇਤਿਹਾਸ ਹੈ ਉਹ ਇਤਿਹਾਸ ਉੱਥੇ ਦੁਹਰਾਇਆ ਜਾਂਦਾ ਨਾਟਕਾਂ ਦੇ ਰਾਹੀਂ ਗੀਤਾਂ ਦੇ ਰਾਹੀਂ ਭੰਗੜੇ ਗਿੱਧੇ ਦੇ ਰਾਹੀਂ ਅਤੇ ਲੋਕ ਪੱਖੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਸਾਨੂੰ ਇਹ ਸਿਖਾਇਆ ਜਾਂਦਾ ਕਿ ਤੁਸੀਂ ਜਿਹੜੀ ਪੰਜਾਬ ਦਾ ਸਾਹਿਤਕ ਵਿਰਸਾ ਉਹਨੂੰ ਸੰਭਾਲ ਕੇ ਰੱਖਣਾ ਅੱਜ ਜਦੋਂ ਪੰਜਾਬ ਦੇ ਅੰਦਰ ਬਹੁਤ ਸਾਰੇ ਸਿੰਗਰ ਬਹੁਤ ਸਾਰੇ ਗੀਤਕਾਰ ਬਹੁਤ ਸਾਰੇ ਗੀਤ ਗਾਉਣ ਵਾਲੇ ਉਹ ਪੰਜਾਬ ਦੇ ਕਲਚਰ ਨੂੰ ਖਰਾਬ ਕਰ ਰਹੇ ਪੱਛਮੀ ਸੱਭਿਆਚਾਰ ਦੀਆਂ ਗੱਲਾਂ ਨੂੰ ਲਿਆ ਕੇ ਸਾਡੇ ਲੋਕਾਂ ਦੇ ਉੱਤੇ ਥੋਪਿਆ ਜਾ ਰਿਹਾ ਤਾਂ ਉਸ ਵੇਲੇ ਗਦਰੀ ਬਾਬਿਆਂ ਦਾ ਜਿਹੜਾ ਮੇਲਾ ਉਹ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਲੋਕਾਂ ਨੂੰ ਚੰਗਾ ਸਾਹਿਤ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਗੱਲ ਕਰਦਾ ਲੋਕਾਂ ਦੇ ਮੰਗਾਂ ਮਸਲਿਆਂ ਦੀ ਗੱਲ ਕਰਦਾ ਪਰ ਦੂਸਰੇ ਪਾਸੇ ਸਾਡੇ ਲੋਕਾਂ ਨੂੰ ਹਥਿਆਰਾਂ ਦੀ ਗੱਲ ਸਿਖਾਈ ਜਾਂਦੀ ਹੈ ਲੜਾਈਆਂ ਦੀ ਗੱਲ ਸਿਖਾਈ ਜਾਂਦੀ ਹੈ ਕਬਜਿਆਂ ਦੀ ਗੱਲ ਸਿਖਾਈ ਜਾਂਦੀ ਹੈ ਤਾਂ ਤਾਂ ਇਸ ਕਰਕੇ ਮੈਂ ਉੱਥੇ ਜਾਂਦਾ ਅਤੇ ਉੱਥੇ ਮੈਂ ਚੰਗੀਆਂ ਕਿਤਾਬਾਂ ਖਰੀਦਣ ਚੰਗੀ ਕਿਤਾਬਾਂ ਪੜ੍ਹਦਾ ਤਾਂ ਮੈਨੂੰ ਉੱਥੇ ਬਹੁਤ ਆਨੰਦ ਆਉਂਦਾ